ਜ਼ਿਆਦਾ ਕਰਕੇ ਭੰਗੜੇ ਅਤੇ ਬੋਲੀਆਂ ਹੀ ਪਾਈ ਜਾਂਦੀਆਂ ਹਨ ਜਿਵੇਂ ਕਿ ਜੇ ਤੂੰ ਨੱਚੀ ਨਾ ਗੋਰੀਏ ਮੇਰੇ ਨਾਲ ਲਹਿੰਗੇ 'ਤੇ ਸ਼ਰਾਬ ਡੋਲ ਦੂੰ ਇੱਕ ਹੋਰ ਗਾਣਾ ਹੈ ਦੇ ਦੇ ਦੇ ਦੇ ਗੇੜਾ ਦੇ ਦੇ ਗੇੜਾ ਸ਼ੌਕ ਦਾ ਨਨਾਣੇ ਗੋਰੀਏ ਮੇਰੀ ਕਾਲੀ ਐਕਟਵਾ ਦਾ ਖੜ੍ਹ ਮੇਰੀ ਕਾਲੀ ਐਕਟਵਾ ਦਾ ਖੜ੍ਹ ਗਿਆ ਹੈਂਡਲ ਫੜ ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ ਸਭਨਾਂ ਨੂੰ ਇੱਕ ਮੌਕਾ ਦਿਆਂਗੇ ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ ਸਭਨਾਂ ਨੂੰ ਇੱਕ ਮੌਕਾ ਦਿਆਂਗੇ ਚਿੱਟੇ ਸੂਟ 'ਤੇ ਦਾਗ ਪੈ ਗਏ ਚਿੱਟੇ ਸੂਟ 'ਤੇ ਦਾਗ ਪੈ ਗਏ ਗਲੀ ਦੇ ਵਿੱਚ ਯਾਰਾ ਨਾਲ ਚਿੱਟੇ ਸੂਟ 'ਤੇ ਦਾਗ ਪੈ ਗਏ ਗਲੀ ਦੇ ਯਾਰਾ ਨਾਲ ਨੀ ਨੀ ਕੋਈ ਕੀਲ ਸਪੇਰਾ ਲੈ ਜਾਊਗਾ ਨਾਗ ਸਾਂਭ ਲੈ ਜੁਲਫਾਂ ਦੇ ਨੀ ਕੋਈ ਕਾਰ ਨੀ ਕੋਈ ਕੀਲ ਸਪੇਰਾ ਲੈ ਜੂਗਾ ਨਾਗ ਸਾਂਭ ਲਾ ਜੁਲਫਾਂ ਦੇ ਟੇਢੀ ਟੇਢੀ ਪੱਗ ਵਾਲਿਆ ਟੇਢੀ ਟੇਢੀ ਪੱਗ ਵਾਲਿਆ ਟੇਢੀ ਟੇਢੀ ਪੱਗ ਵਾਲਿਆ ਨੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਨਾ ਵੇਖਿਆ ਵੰਝਲੀ ਵਜਾ ਨੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਵੇਖਿਆ ਵੰਝਲੀ ਵਜਾ ਇੱਦਾਂ ਕਰਕੇ ਹੀ ਬਹੁਤ ਸਾਰੇ ਨੱਚਣ ਵਾਲੇ ਗੀਤ ਹਨ ਜੇ ਤੂੰ ਨੱਚੀ ਨਾ ਗੋਰੀਏ ਮੇਰੇ ਨਾਲ ਲੈਗੇ ਲਹਿੰਗੇ 'ਤੇ ਸ਼ਰਾਬ ਡੋਲੂ ਦੂੰ ਨੀ ਜੇ ਤੂੰ ਨੱਚੀ ਗੋਰੀਏ ਮੇਰੇ ਨਾਲ ਲਹਿੰਗੇ 'ਤੇ ਸ਼ਰਾਬ ਡੋਲ ਦੂੰ